ਜਦੋਂ ਅਸੀਂ ਆਨਲਾਈਨ ਸ਼ੋਪਿੰਗ ਕੀਤੀ ਤਾਂ ਅਸੀਂ ਇੱਕ ਨਵਾਂ ਪ੍ਰੋਡਕਟ ਪਰਚੇਸ ਕੀਤਾ ਸੀ ਆਨਲਾਈਨ ਡਰੈਸ ਮੰਗਵਾਈ ਸੀ ਜੋ ਕਿ ਅਸੀਂ ਅਚਾਨਕ ਕਿਸੇ ਮੈਰਿਜ ਤੇ ਜਾਣਾ ਸੀ ਉਸਦੇ ਦੌਰਾਨ ਸਾਨੂੰ ਉਹ ਆਰਡਰ ਹਜੇ ਤੱਕਰ ਨਹੀਂ ਮਿਲਿਆ ਤੇ ਸਾਨੂੰ ਉਸੇ ਦਾ ਕਾਰਨ ਬਹੁਤ ਜਿਆਦਾ ਪਰੇਸ਼ਾਨੀ ਹੋ ਰਹੀ ਹੈ ਕਿ ਫਿਰ ਆਪਣੇ ਫਰੈਂਡ ਨਾਲ ਕਾਲ ਕੀਤੀ ਤੇ ਉਸ ਨੂੰ ਪੁੱਛਿਆ ਕਿ ਮੈਂ ਆਪਣੀ ਆਨਲਾਈਨ ਇੱਕ ਡਰੈੱਸ ਮੰਗਵਾਈ ਸੀ ਕੀ ਉਹ ਮੈਨੂੰ ਐ ਚੱਕਰ ਨਹੀਂ ਮਿਲੀ ਤੇ ਉਸਨੇ ਮੈਨੂੰ ਕਿਹਾ ਕਿ ਫਿਰ ਤੂੰ ਦੁਬਾਰਾ ਆਨਲਾਈਨ ਜਾ ਤੇ ਦੇਖ ਤੇਰੀ ਜਿਹੜੀ ਤੂੰ ਡਰੈਸ ਔਨਲਾਈਨ ਮੰਗਵਾਈ ਸੀ ਉਹ ਡਿਲੀਵਰ ਹੋਈ ਆ ਕਿ ਨਹੀਂ ਤੇ ਕਈ ਦਿਨਾਂ ਤੋਂ ਉਹ ਡਰੈਸ ਮੈਂ ਆਰਡਰ ਕੀਤੀ ਹੋਈ ਸੀ ਤੇ ਜਿਸ ਦੇ ਕਾਰਨ ਉਹ ਮੈਨੂੰ ਨਹੀਂ ਮਿਲ ਸਕੀ ਤੇ ਮੈਨੂੰ ਇਸ ਤਰ੍ਹਾਂ ਹੀ ਕਿਸੇ ਮੈਰਿਜ ਤੇ ਜਾਣਾ ਪਿਆ ਤੇ ਜਦੋਂ ਮੈਨੂੰ ਡਰੈਸ ਮਿਲੀ ਤਾਂ ਉਹ ਬਹੁਤ ਹੀ ਲੇਟ ਮਿਲੀ ਇਸ ਕਾਰਨ ਮੈਨੂੰ ਉਸਦਾ ਘਰ ਡਰੈਸ ਕਾਰਨ ਬਹੁਤ ਜਿਆਦਾ ਦਿੱਕਤ ਦਾ ਸਾਹਮਣਾ ਕਰਨਾ ਪਿਆ ਤੇ ਕਿਰਪਾ ਕਰਕੇ ਤੁਸੀਂ ਆਨਲਾਈਨ ਪ੍ਰੋਡੈਕਟ ਸਾਨੂੰ ਟਾਈਮ ਸਿਰ ਦਿੱਤਾ ਜਾਵੇ ਤੇ